ਅੱਜ ਦਾ ਯੁੱਗ ਤਾਂ ਟਕਨੋਲਜੀ ਦਾ ਯੁੱਗ ਹੈ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਇਨਸਾਨ ਨੂੰ ਇਸ ਟਕਨੋਲਜੀ ਦੇ ਬਾਰੇ ਪਤਾ ਹੋਵੇ ਇਸ ਲਈ ਜੇ ਮੰਨ ਲਓ ਕਿਸੇ ਇੱਕ ਨੌਜਵਾਨ ਬੰ ਬੰਦੇ ਨੇ ਪੈਸੇ ਕਢਾਉਣੇ ਹੋਣ ਤਾਂ ਮੈਂ ਸਭ ਤੋਂ ਪਹਿਲਾਂ ਉਸ ਨੂੰ ਏਟੀਐੱਮ ਦੀ ਵਿਧੀ ਦਾ ਸਭ ਤੋਂ ਸੌਖਾ ਤਰੀਕਾ ਦੱਸੂਗੀ ਉਸ ਨੂੰ ਕਹੂੰਗੀ ਕੀ ਤੂੰ ਏਟੀਐੱਮ ਮਸ਼ੀਨ ਵਿੱਚ ਜਾ ਕੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਕਾਰਡ ਦਾ ਕਾਰਡ ਨੂੰ ਪਾਉਣਾ ਹੈ ਅਤੇ ਉਸ ਦੇ ਅੰਦਰ ਪਾਉਣ ਤੋਂ ਬਾਅਦ ਆਪਣਾ ਪਾ ਪਿੰਨਕੋਡ ਪਾਉਣਾ ਹੈ ਫੇਰ ਪਿੰਨਕੋਡ ਪਾਉਣ ਤੋਂ ਬਾਅਦ ਉਸ 'ਤੇ ਜਿੱਦਾਂ ਜਿੱਦਾਂ ਕ ਆਉਣਗੇ ਕੀ ਹਾਂ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੈਸ਼ ਕਢਾਉਣਾ ਚਾਹੁੰਦੇ ਹੋ ਜਾਂ ਜਮ ਕਢਾਉਣਾ ਚਾਹੁੰਦੇ ਹੋ ਜਾਂ ਉਸ ਦੀ ਡਿਟੇਲ ਲੈਣਾ ਚਾਹੁੰਦੇ ਹੋ ਫਿਰ ਉਸ ਨੂੰ ਮੈਂ ਦੱਸਾਂਗੀ ਤੂੰ ਜੋ ਵੀ ਕਰਾਉਣਾ ਹੈ ਉਸ ਬਟਨ ਦੇ ਉੱਤੇ ਆਪਣੀ ਭਾਸ਼ਾ ਦਾ ਚੋਣ ਕਰਨ ਤੋਂ ਬਾਅਦ ਤੂੰ ਉਸ ਦੇ ਉੱਤੇ ਗ ਜਿੱਦਾਂ ਬਟਨ ਦੱਬ ਦੇਣਾ ਹੈ ਤਾਂ ਜੋ ਤੈਨੂੰ ਪੈਸੇ ਕਢਾਉਣ ਦਾ ਪਤਾ ਲੱਗ ਸਕੇ ਸਭ ਤੋਂ ਪਹਿਲਾਂ ਉਸ ਨੇ ਆਪਣੀ ਭਾਸ਼ਾ ਦਾ ਚੋਣ ਕਰਨ ਤੋਂ ਬਾਅਦ ਆਪਣੀ ਫਿਰ ਉਸ ਨੇ ਬਟਨ ਨੂੰ ਫਾਸਟਰ ਕ ਸਭ ਤੋਂ ਪੈਸੇ ਕਢਾਉਣ ਵਾਲੇ ਬਟਨ ਨੂੰ ਦੱਬਣਾ ਹੈ ਪੈਸੇ ਕਢਾਉਣ ਵਾਲਾ ਬਟਨ ਦੱਬਣ ਤੋਂ ਬਾਅਦ ਫਿਰ ਉਸ ਨੂੰ ਆਉਂਦਾ ਹੈ ਚੋਣ ਆਉਂਦੀ ਹੈ ਕੀ ਤੈਨੂੰ ਕੀ ਪੈਸੇ ਕਿੰਨੇ ਪੈਸੇ ਚਾਹੀਦੇ ਹਨ ਪੈਸੇ ਭਰਨ ਤੋਂ ਬਾਅਦ ਫੇਰ ਉਹ ਉਸ ਦੇ ਵਿੱਚ ਗਿਣੇਗਾ ਕੀ ਉਸ ਨੂੰ ਪੰਜ ਸੌ ਦੇ ਨੋਟਸ ਚਾਹੀਦੇ ਹਨ ਜਾਂ ਸੌ ਦੇ ਨੋਟ ਚਾਹੀਦੇ ਹਨ ਫਿਰ ਉਸ ਤੋਂ ਬਾਅਦ ਆਏਗਾ ਜਦੋਂ ਉਹ ਆਪਣੇ ਪੰਜ ਸੌ ਦੇ ਨੋਟਾਂ ਨੂੰ ਬ ਬਟਨ ਨਾਲ਼ ਦੱਬ ਦਿੰਦਾ ਹੈ ਤਾਂ ਫਿਰ ਉਹ ਆਪਣੀ ਆਪਣੀ ਅਮਾਊਂਟ ਨੂੰ ਵੀ ਆਪਣੇ ਪੈਸੇ ਨੂੰ ਵੀ ਲਿਖ ਦਿੰਦਾ ਹੈ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਹਨ ਜਦੋਂ ਉਹ ਦੋ ਹਜ਼ਾਰ ਰਪਈਆ ਲਿਖ ਦਿੰਦਾ ਹੈ ਤਾਂ ਉਸ ਵਿੱਚੋਂ ਪੰਜ ਸੌ ਦੀ ਚੋਣ ਦੇ ਮੁਤਾਬਿਕ ਉਸ ਨੂੰ ਚਾਰ ਨੋਟ ਆ ਜਾਂਦੇ ਹਨ ਇਸ ਤਰ੍ਹਾਂ ਉਹ ਆਪਣਾ ਪੈਸਿਆਂ ਨੂੰ ਆਪਣੇ ਸੌਖੇ ਢੰਗ ਦੇ ਨਾਲ਼ ਕੱਢ ਸਕਦਾ ਹੈ ਅਤੇ ਆਪਣੇ ਟਾਈਮ ਦੇ ਸਮੇਂ ਦੇ ਉੱਤੇ ਇਸ ਪੈਸੇ ਦਾ ਇਸਤੇਮਾਲ ਵੀ ਕਰ ਸਕਦਾ ਹੈ ਜਿਹੜਾ ਕਿ ਸਭ ਤੋਂ ਸੌਖਾ ਤਰੀਕਾ ਹੈ